ਛੰਦ ਇੱਕ ਦੋਹਾ ਹੈ ਵਿਆਹ ਦੇ ਦੌਰਾਨ ਦੁਲਹਾ ਨਵੇਂ ਸਸੁਰਾਲ ਵਾਲਿਆਂ ਦੀ ਤਾਰੀਫ਼ ਜਾਂ ਉਸਦੀ ਟੰਗ ਖਿੱਚਣ ਲਈ ਛੰਦ ਪੜ੍ਹਦਾ ਹੈ ਇਹ ਇੱਕ ਰਿਵਾਜ਼ ਹੈ ਛੰਦ ਸੁਣਨ ਤੋਂ ਬਾਅਦ ਉਹਦੀ ਸੱਸ ਆਪਣੇ ਜਵਾਈ ਨੂੰ ਥੋ ਕੋਈ ਨਾ ਕੋਈ ਤੋਹਫ਼ਾ ਦਿੰਦੀ ਹੈ ਇਹ ਅਕਸਰ ਵਿਆਹਾਂ 'ਤੇ ਹੀ ਛੰਦ ਪੜ੍ਹੇ ਜਾਂਦੇ ਨੇ